ਹੈਲੋ ਜੀ ਹਾਂਜੀ ਵੀਰ ਜੀ ਅਮਨਦੀਪ ਬੋਲ ਅੱਛਾ ਜੀ ਵਧੀਆ ਗੱਲ ਆ ਹਾਂਜੀ ਹਾਂਜੀ ਬਰਨਾਲਾ ਡਿਸਟਰਿਕਟ ਤਾਂ ਬ ਮਤਲਬ ਆਪਣਾ ਮੇਨ ਡਿਸਟਰਿਕਟ ਹੈ ਅਤੇ ਇਤਿਹਾਸਿਕ ਜਗ੍ਹਾ ਬਹੁਤ ਨੇ ਤੁਸੀਂ ਕਿਸ ਤਰ੍ਹਾਂ ਦੇ ਮਤਲਬ ਕਿਸ ਤਰ੍ਹਾਂ ਦੀ ਅੱਛਾ ਪਾਰਕ ਵਗੈਰਾ ਬੱਚਿਆਂ ਵਾਸਤੇ ਓਕੇ ਪਾਰਕ ਜੀ ਇੱਕ ਤਾਂ ਬਹੁਤ ਪੁਰਾਣਾ ਪਾਰਕ ਹੈ ਚਿੰਟੂ ਪਾਰਕ ਬੋਲਦੇ ਨੇ ਉੱਥੇ ਆਪਣੇ ਖਾੜਕੂਵਾਦ ਦੇ ਸਮੇਂ ਮਤਲਬ ਗੋਲੀ ਚੱਲੀ ਸੀ ਅਤੇ ਬਹੁਤ ਬੰਦੇ ਮਰ ਗਏ ਸੀ ਉਹਦਾ ਨਾਮ ਸੀ ਮਤਲਬ ਉੱਥੇ ਚਿੰਟੂ ਨਾਮ ਰ ਚਿੰਟੂ ਨਾਮ ਦੇ ਬੱਚੇ ਦੇ ਨਾਂ 'ਤੇ ਰੱਖਿਆ ਚਿੰਟੂ ਪਾਰਕ ਉਹਦਾ ਨਾਂ ਹੈ ਅਤੇ ਸਭ ਤੋਂ ਵਧੀਆ ਸ਼ਹਿਰ ਦੇ ਵਿਚਕਾਰ ਹੈ ਅਤੇ ਮਤਲਬ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਬੜਾ ਮਨ ਲੱਗਦਾ ਲੱਗੇ ਵੇ ਹੈ ਲੱਗੇ ਵੇ ਹੈ ਝੂਲੇ ਵਗੈਰਾ ਲੱਗੇ ਹੋਏ ਆ ਅਤੇ ਵਾਕਈ ਪਾਰਕ ਬਣਿਆ ਹੋਇਆ ਤੁਸੀਂ ਸੈਰ ਕਰ ਸਕਦੇ ਹੋ ਬਕਾਇਦਾ ਉਹਦਾ ਅਲੱਗ ਤੋਂ ਰਸਤਾ ਬਣਾਇਆ ਹੋਇਆ ਪੱਕਾ ਅਤੇ ਹਾਂ ਬਰਨਾਲਾ ਦਾ ਕਿਲ੍ਹਾ ਹੈਗੀ ਮਸ਼ਹੂਰ ਜੀ ਬਾਬਾ ਆਲਾ ਦਾ ਕਿਲ੍ਹਾ ਅਤੇ ਅਤੇ ਦੂਜਾ ਇਹਦੇ ਨਾਲ ਹੀ ਹੈ ਪਾਰਕ ਸ਼ਹੀਦ ਭਗਤ ਸਿੰਘ ਪਾਰਕ ਉਹ ਨਵਾਂ ਡਿਵੈਲਪ ਕੀਤਾ ਉਹ ਕਾਫੀ ਜਗ੍ਹਾ ਦੇ ਵਿੱਚ ਡਿਵੈਲਪ ਕੀਤਾ ਗਿਆ ਅਤੇ ਬਕਾਇਦਾ ਉਹਦੇ 'ਚ ਬਹੁਤ ਤਰ੍ਹਾਂ ਦੀ ਵਰਾਇਟੀ ਨਾਲ ਮਤਲਬ ਪੌਦੇ ਲਾਏ ਹੋਏ ਨੇ ਅਤੇ ਵਿੱਚ ਗਰਾਊਂਡ ਬਣੇ ਹੋਏ ਨੇ ਅਤੇ ਸਾਡੇ ਜਿਵੇਂ ਪ੍ਰੋਗਰਾਮ ਵਗੈਰਾ ਜਦੋਂ ਵੀ ਕੋਈ ਹੁੰਦੇ ਨੇ ਤਾਂ ਉਹ ਪਾਰਕ 'ਚ ਹੀ ਕਰਵਾਏ ਜਾਂਦੇ ਨੇ ਅਤੇ ਜੇ ਤੁਸੀਂ ਇੱਕ ਵਾਰੀ ਆਉਂਗੇ ਬੜਾ ਹਾਂ ਪੂਰੀ ਖੁੱਲ੍ਹੀ ਪੂਰੀ ਪੂਰੀ ਖੁੱਲ੍ਹੀ ਜਗ੍ਹਾ ਜੀ ਖੁਸ਼ ਹੋ ਜਾਵੋਂਗੇ ਤੁਹਾਡਾ ਮਨ ਖੁਸ਼ ਹੋਜੂ ਆ ਕੇ ਐਨਾ ਸੋਹਣਾ ਵਾਤਾਵਰਨ ਆ ਉੱਥੇ ਅਤੇ ਘਾਹ ਘੂਹ ਲੱਗਿਆ ਹੋਇਆ ਸਹੀ ਗਰਾਊਂਡ ਸਹੀ ਮਤਲਬ ਮੈਦਾਨ ਹੈ ਘਾਹ ਦੇ ਆਲੇ ਦੁਆਲੇ ਮਤਲਬ ਸੋਹਣੇ ਜਿਹੇ ਪਾਰਕ ਬਣੇ ਵੇ ਨੇ ਚੱਲਣ ਫਿਰਨ ਵਾਸਤੇ ਝੂਲੇ ਲੱਗੇ ਹੋਏ ਨੇ ਬਕਾਇਦਾ ਬੱਚੇ ਖੇਡਦੇ ਰਹਿੰਦੇ ਨੇ ਅਤੇ ਦਿਨ ਰਾਤ ਓਪਨ ਹੈ ਲੋਕੇਲਟੀ ਦੇ ਵਿੱਚ ਹੈ ਤੁਸੀਂ ਜੇ ਤੁਸੀਂ ਆਉਣਾ ਹੋਵੇ ਤਾਂ ਮਤਲਬ ਭਗਤ ਸਿੰਘ ਪਾਰਕ ਸਿੱਧਾ ਪੁੱਛ ਕੇ ਆ ਸਕਦੇ ਹੋ ਓਪਨ ਜੀ ਓਪਨ ਓਪਨ ਟਵੈਂਟੀ ਫੋਰ ਚੌਵੀ ਘੰਟੇ ਓਪਨ ਆ ਬਕਾਇਦਾ ਲਾਇਟਿੰਗ ਲੂਟਿੰਗ ਲੱਗੀ ਵੀ ਹੈ ਬਸ ਸਟੈਂਡ ਤੋਂ ਇਹ ਹਾਂ ਕਿਲੋਮੀਟਰ ਕੁ ਹੋਊਗਾ ਜੇ ਵਾਇਆ ਬੱਸ ਆਉਂਦੇ ਤਾਂ ਕੋਈ ਵੀ ਰਿਕਸ਼ਾ ਜਾਂ ਆਟੋ ਕਰਕੇ ਤੁਸੀਂ ਸਿਰਫ ਭਗਤ ਸਿੰਘ ਪਾਰਕ ਕਹਿ ਦਿਉ ਬੜੇ ਅਸਾਨੀ ਨਾਲ ਪਹੁੰਚ ਜਾਉਂਗੇ ਬਿਲਕੁਲ ਸ਼ਹਿਰ ਦੇ ਵਿੱਚ ਹੈ ਹਾਂ ਬੱਚਾ ਵੇਟ ਕਰੋ ਦੱਸਾਗੇ ਹਾਂ ਤੁਸੀਂ ਕਿਲ੍ਹਾ ਵੀ ਦਿਖਾਓ ਚਲੋ ਕਿਲ੍ਹਾ ਤਾਂ ਨਹੀਂ ਬੱਚਿਆਂ ਵਾਲਾ ਦਿਖਾਉ ਉਹ ਵੀ ਪਾਰਕ ਵੀ ਦੋਹੇਂ ਦੇਖਣ ਵਾਲੇ ਨੇ ਹਾਂਜੀ ਹਾਂਜੀ ਹਾਂਜੀ ਕਾਲ ਕਰ ਲਿਓ ਜਦੋਂ ਜਦੋਂ ਆਉਂਗੇ ਠੀਕ ਹੈ